ਸਾਡੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਹੈ ਇੱਥੇ ਪਾਣੀ ਦਾ ਬਹੁਤ ਵਧੀਆ ਸੰਵਿਧਾਨ ਕੀਤਾ ਹੋਇਆ ਵਾ ਇੱਥੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੈ ਜੇ ਵੇਖਿਆ ਜਾਵੇ ਤਾਂ ਇੱਥੇ ਪਾਣੀ ਕਿੱਥੇ ਪਾਣੀ ਕਿੱਥੋਂ ਕਿੱਥੋਂ ਵੱਖ ਵੱਖ ਕਿਹੜੀ ਸਰੋਤ ਜਿਥੋਂ ਪਾਣੀ ਆਉਂਦਾ ਪਹਿਲਾ ਸਰੋਤ ਹੈਗਾ ਨਹਿਰਾਂ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਨਹਿਰਾਂ ਚੱਲਦੀਆਂ ਨੇ ਉਨ੍ਹਾਂ ਤੋਂ ਅਸੀਂ ਪਾਣੀ ਲੈ ਸਕਦੇ ਹਾਂ ਨਲਕਿਆਂ ਤੋਂ ਆਰ ਓ ਤੋਂ ਲੈ ਸਕਦੇ ਹਾਂ ਜੋ ਕਿ ਘਰਾਂ ਵਿੱਚ ਲੱਗਿਆ ਹੁੰਦਾ ਜੇ ਇਹ ਸਭ ਚੀਜ਼ਾਂ ਨਹੀਂ ਵੀ ਹੁੰਦੀਆਂ ਤਾਂ ਅਸੀਂ ਘਰ ਦੇ ਵਿੱਚ ਮੱਛੀ ਮੋਟਰ ਵੀ ਕਰਾ ਸਕਦੇ ਹਾਂ ਅਸੀਂ ਉਸਦਾ ਪਾਣੀ ਪੀਏ ਉਹ ਵੀ ਸਾਡੇ ਤੱਕ ਬਹੁਤ ਹੀ ਲਾਭਦਾਇਕ ਹੁੰਦਾ ਹੈ ਅਕਸਰ ਲੋਕ ਕਹਿ ਦਿੰਦੇ ਜੀ ਵੀ ਮੱਛੀ ਮੋਟਰ ਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂ ਨਹੀਂ ਪੀਣਾ ਚਾਹੀਦਾ ਬਈ ਇਹ ਤਾਂ ਕੋਈ ਗੱਲ ਨਹੀਂ ਹੋਈ ਬਿਲਕੁਲ ਪੀਣਾ ਚਾਹੀਦਾ ਅਤੇ ਸਾਡੇ ਸਕੂਲ ਸਾਡੇ ਘਰ ਦੇ ਵਿੱਚ ਪੂਰੇ ਸਾਲ ਜਿਹੜਾ ਇਹ ਸਰੋਤ ਆ ਉਹ ਆਰ ਓ 'ਚੋ ਜੇ ਕਈ ਵਾਰ ਇਸ ਇਹ ਹੁੰਦਾ ਕਿ ਬਈ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਵੀ ਅਸੀਂ ਸਾਡਾ ਆਰ ਓ ਖ਼ਰਾਬ ਹੋ ਗਿਆ ਅਸੀਂ ਕਿੱਥੋਂ ਪਾਣੀ ਲਿਆਵਾਂਗੇ ਤਾਂ ਬਿਲਕੁਲ ਅਸੀਂ ਨਹਿਰਾਂ ਤੋਂ ਜਾ ਕੇ ਪਾਣੀ ਲਿਆਵਾਂਗੇ ਉਹ ਸਾਡੇ ਲਈ ਜ਼ਿਆਦਾ ਜ਼ਰੂਰੀ ਆ ਪਰ ਜੇ ਹੁਣ ਦੇਖੀਏ ਤਾਂ ਨਹਿਰਾਂ ਦਾ ਪਾਣੀ ਵੀ ਦੂਸ਼ਿਤ ਹੁੰਦਾ ਜਾ ਰਿਹਾ ਜਿਹੜੀਆਂ ਫੈਕਟਰੀਆਂ ਵਾ ਉਹ ਪਾਣੀ ਨੂੰ ਗੰਦਾ ਕਰ ਰਹੀਆਂ ਵਾ ਉਹਨਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਪਰ ਜਿਹੜੀਆਂ ਸਰਕਾਰਾਂ ਉਹ ਨਹੀਂ ਕਰ ਰਹੀਆਂ ਪਾਣੀ ਵੱਲ ਕੋਈ ਜ਼ਿਆਦਾ ਧਿਆਨ ਦਿੱਤਾ ਨਹੀਂ ਜਾ ਰਿਹਾ ਖ਼ਾਸ ਲੇਕਿਨ ਇੰਨਾ ਸਭ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਬਹੁਤ ਜ਼ਰੂਰੀ ਆ ਕਿਉਂਕਿ ਇਸ ਵਧੀਆ ਪਾਣੀ ਫਰੈਸ਼ ਪਾਣੀ ਵਧੀਆ ਉਹਦੇ ਵਿੱਚ ਕੋਈ ਪ੍ਰਦੂਸ਼ਣ ਨਾ ਹੋਵੇ ਅਸੀਂ ਉਹ ਹੀ ਪੀਵਾਂਗੇ ਤਾਂ ਹੀ ਅਸੀਂ ਤੰਦਰੁਸਤ ਰਹਾਂਗੇ ਇੱਦਾਂ ਤਾਂ ਵੀ ਸਾਡੇ ਸਰੀਰ ਨੂੰ ਬਿਮਾਰੀਆਂ ਹੀ ਲੱਗੀ ਜਾਣਗੀਆਂ ਜੀ ਗੰਦਾ ਪਾਣੀ ਅਸੀਂ ਪੀਵਾਂਗੇ ਸਾਨੂੰ ਕਿੰਨੀਆਂ ਬਿਮਾਰੀਆਂ ਲੱਗਣੀਆਂ ਬਹੁਤ ਬੀਮਾਰੀਆਂ ਲੱਗਣੀਆਂ ਅਸੀਂ ਤਾਂ ਰਹਿਣਾ ਹੀ ਨਹੀਂ ਕਿਸੇ ਜੋਗੇ ਪੈਸੇ ਖਰਚੇ ਹੋਈ ਜਾਣੇ ਸਾਡੇ ਤਾਂ ਪਾਣੀਆਂ 'ਤੇ ਹੀ ਬਿਮਾਰੀਆਂ 'ਤੇ ਹੀ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਅਤੇ ਪਾਣੀ ਨੂੰ ਵਧੀਆ ਢੱਕ ਕੇ ਰੱਖੋ ਤਾਂ ਕਿ ਉਹ ਵਧੀਆ ਰਹੇ ਫਰੈਸ਼ ਰਹੇ ਪਾਣੀ ਪੀ ਸਕੀਏ ਉਹਦੇ ਵਿੱਚ ਮੱਛਰ ਮੁੱਛਰ ਨਾ ਗਿਰਨ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ